ਹੈਲੋ ਗੁਰੀ ਵੀਰ ਕਿਆ ਹਾਲ ਹੈ ਹੋਰ ਕਿੱਦਾਂ ਮੈਂ ਸੁਣਿਆ ਸੀਗਾ ਵੀ ਆਪਣਾ ਤੈਂ ਵਾਲੀਬਾਲ 'ਚ ਹਿੱਸਾ ਲੈਣਾ ਸੀਗਾ ਅਤੇ ਆਪਣੇ ਇੱਥੇ ਰੋਪੜ ਗੌਰਮਿੰਟ ਕਾਲਜ ਹੈਗਾ ਨਾ ਉੱਥੇ ਕੋਚ ਸਾਹਿਬ ਆਪਣੇ ਇੰਦਰਜੀਤ ਸਿੰਘ ਜੀ ਅਤੇ ਉਹ ਵਧੀਆ ਸਿਖਲਾਈ ਦਿੰਦੇ ਹਨ ਅਤੇ ਬਹੁਤ ਵਧੀਆ ਸਮਝਾਉਂਦੇ ਆ ਤਰੀਕੇ ਨਾਲ ਅਤੇ ਬਹੁਤ ਵਧੀਆ ਸਾਰਾ ਕੁਛ ਆ ਇੱਥੇ ਖਾਣ ਪੀਣ ਦਾ ਪ੍ਰਬੰਧ ਫੁੱਲ ਹੈ ਕੋਈ ਇੱਦਾਂ ਦੀ ਗੱਲ ਵੀ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਅਤੇ ਆਪਣਾ ਹਰ ਇੱਕ ਮਹੀਨੇ ਹਰ ਇੱਕ ਕਾਲਜ ਦੇ ਕਾਲਜਾਂ ਦੀਆਂ ਟੀਮਾਂ ਆਉਂਦੀਆਂ ਬਹੁਤ ਤਰੀਕੇ ਨਾਲ ਖਿਲਾਉਂਦੇ ਆ ਅਤੇ ਜਿਹੜੇ ਬੱਚੇ ਨੂੰ ਉਹ ਸਮਝਾਉਂਦੇ ਆ ਚੰਗੀ ਤਰ੍ਹਾਂ ਉਹ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਅੱਵਲ ਆਉਂਦਾ ਦੇ ਕਾਫੀ ਜ਼ਿਆਦਾ ਅੱਗੇ ਵੱਲ ਨੂੰ ਵਧਦਾ